ਹੁਣ ਅਸੀਂ ਗੱਲ ਕਰਾਂਗੇ ਕਸਰਤ ਕਰਨਾ ਕਿਉਂ ਜ਼ਰੂਰੀ ਹੈ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਸਿਹਤ ਹੀ ਖਜ਼ਾਨਾ ਹੈ ਇਸ ਤੋਂ ਅਰਥ ਇਹ ਹੈ ਵੀ ਜਿਹੜੀ ਆਪਣੀ ਸਿਹਤ ਹੈ ਉਹੀ ਆਪਣਾ ਅਸਲ ਖਜ਼ਾਨਾ ਹੈ ਕੋਈ ਉਹੀ ਅਸਲ ਧਨ ਉਹੀ ਅਸਲ ਅਸਲ ਦੌਲਤ ਹੁੰਦੀ ਹੈ ਕਿਉਂਕੀ ਜਿਹੜਾ ਸਰੀਰ ਹੈ ਆਪਣਾ ਜੇ ਸਰੀਰ ਤੰਦਰੁਸਤ ਰਹੂਗਾ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰ ਸਕਦੇ ਹਾਂ ਜੇਕਰ ਆਪਣਾ ਸਰੀਰ ਫਿੱਟ ਨਹੀਂ ਹੈਗਾ ਤਾਂ ਆਪਾਂ ਕੋਈ ਵੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਇਸ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਹੁਣ ਆਪਾਂ ਗੱਲ ਕਰਾਂਗੇ ਵੀ ਕਸਰਤ ਕਰ ਕਰਨ ਦੇ ਢੰਗ ਕਿਹੜੇ ਕਿਹੜੇ ਹੈ ਕਸਰਤ ਕਰਨ ਦੇ ਢੰਗ ਪੁਰਾਤਨ ਢੰਗ ਇਹ ਨੇ ਵੀ ਆਪਾਂ ਰਨਿੰਗ ਕਰੀਏ ਘਰੇਲੂ ਐਕਸਾਈਜਾਂ ਕਰੀਏ ਅਤੇ ਇਸ ਤੋਂ ਇਲਾਵਾ ਦੂਸਰਾ ਜਿਹੜਾ ਆਪਣਾ ਨਵੀਨ ਨਵੀਤਮ ਦੇ ਵਿੱਚ ਆ ਜਾਂਦਾ ਹੈ ਨਵੀਤਮ ਢੰਗ ਆ ਜਾਂਦਾ ਹੈ ਉਹ ਹੈ ਜਿਮ ਜਿਮ ਜਾਣਾ ਸਵਿਮਿੰਗ ਕਰਨਾ ਡਾਂਸਿੰਗ ਕਰਨਾ ਇਹ ਸਾਰੀਆਂ ਚੀਜ਼ਾਂ ਸਾਨੂੰ ਫਿੱਟ ਰੱਖਦੀਆਂ ਨੇ ਗੀਆਂ ਤਾਂ ਸਾਨੂੰ ਕਸਰਤ ਕਰਨ ਦੇ ਨਾਲ ਨਾਲ ਸ ਆਪਣਾ ਜਿਹੜਾ ਸਰੀਰ ਆ ਉਹ ਫਿੱਟ ਰੱਖਣਾ ਚਾਹੀਦਾ ਹੈ ਜਿਮ ਜਾਣਾ ਚਾਹੀਦਾ ਹੈ ਅਤੇ ਜੇ ਜਿਮ ਨਹੀਂ ਜਾ ਸਕਦੇ ਹੈ ਤਾਂ ਤੁਹਾਨੂੰ ਸਾਨੂੰ ਆਪਣੇ ਸਰੀਰ ਦੇ ਲਈ ਘੱਟੋ ਘੱਟ ਇੱਕ ਘੰਟਾ ਡੇਲੀ ਕੱਢਣਾ ਚਾਹੀਦਾ ਹੈ ਸਵੇਰ ਦੀ ਸੈਰ ਕਰੋ ਅਤੇ ਇਸ ਤੋਂ ਇਲਾਵਾ ਸਵੇਰੇ ਐਕਸਾਈਜਸ ਕਰੋ ਯੋਗਾ ਕਰੋ ਇਹ ਸਾਰੀਆਂ ਗੱਲਾਂ ਸਾਨੂੰ ਫਿੱਟ ਰੱਖਦੀਆਂ ਨੇ ਗੀਆਂ ਸਾਡਾ ਸਰੀਰ ਜੇ ਫਿੱਟ ਹੋਊਗਾ ਤਾਹੀਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਹਾਂ ਤਾਹੀਂ ਆਪਾਂ ਚੰਗਾ ਸੋਚ ਸਕਦੇ ਹਾਂ ਅਤੇ ਤਾਹੀਂ ਜ਼ਿੰਦਗੀ ਦੇ ਵਿੱਚ ਆਪਾਂ ਚੰਗੀ ਜਿਹੜੀ ਮੰਜ਼ਿਲ ਹੈ ਉਹ ਆਪਾਂ ਆਪਣੀ ਹਾਸਿਲ ਕਰ ਸਕਦੇ ਹਾਂ ਗੇ ਅਤੇ ਜਿਮ ਜਿਮ ਦੇ ਵਿੱਚ ਡੇਲੀ ਜਾਣਾ ਇਹ ਵੀ ਬਹੁਤ ਚੰਗਾ ਚੰਗੀ ਹੌਬੀ ਹੈ ਸਾਨੂੰ ਜਿਮ ਜਾਣਾ ਚਾਹੀਦਾ ਹੈ ਜਿਮ ਦੇ ਵਿੱਚ ਦਿੱਤੀਆਂ ਹੋਈਆਂ ਐਕਸਾਈਜਜ਼ ਦੇ ਹਿਸਾਬ ਨਾਲ ਸਾਨੂੰ ਕਰਨੀਆਂ ਚਾਹੀਦੀਆਂ ਨੇ ਗੀਆਂ ਜਿਹਦੇ ਵਿੱਚ ਆਪਾਂ ਕਈ ਵਾਰ ਦੇਖਦੇ ਹਾਂ ਵੀ ਓਵਰਵੇਟ ਹੋਏ ਇਨਸਾਨ ਨੇ ਉਹ ਆਪਣੇ ਮੋਟਾਪੇ ਕਰਕੇ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਉਹਨੂੰ ਕਈ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਪਰ ਜੇਕਰ ਆਪਾਂ ਜਿਮ ਜਾਨੇ ਹਾਂ ਨਿਰੰਤਰ ਅਭਿਆਸ ਕਰਦੇ ਹਾਂ ਕਸਰਤ ਕਰਦੇ ਹਾਂ ਤਾਂ ਆਪਣਾ ਜਿਹੜਾ ਸਰੀਰ ਹੈ ਉਹ ਬਹੁਤ ਫਿੱਟ ਰਹਿੰਦਾ ਤੰਦਰੁਸਤ ਰਹਿੰਦਾ ਤਾਂ ਆਪਾਂ ਹਰੇਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਚਾਅ ਦੇ ਨਾਲ ਕਰਦੇ ਹਾਂ ਜੇਕਰ ਆਪਾਂ ਐਕਸਾਈਜ ਨਹੀਂ ਕਰਾਂਗੇ ਆਪਣਾ ਸਰੀਰ ਫਿੱਟ ਨਹੀਂ ਰੱਖਾਂਗੇ ਤਾਂ ਆਪਾਂ ਨੂੰ ਕੋਈ ਵੀ ਕੰਮ ਦੇ ਵਿੱਚ ਕਰਨ ਦੇ ਵਿੱਚ ਕੋਈ ਮਜ਼ਾ ਨਹੀਂ ਆਊਗਾ ਤਾਂ ਇਸ ਲਈ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣ ਲਈ ਜਿਹੜੀ ਐਕਸਰਸਾਈਜ ਆ ਕਸਰਤ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕੀ ਰੱਬ ਨੇ ਸਾਨੂੰ ਜੋ ਸਰੀਰ ਦਿੱਤਾ ਹੈ ਉਹ ਅਨਮੋਲ ਹੈ ਉਹਦਾ ਕੋਈ ਮੋਲ ਨਹੀਂ ਇਹ ਲੱਖਾਂ ਕਰੋੜਾਂ ਤੋਂ ਵੀ ਵੱਧ ਕੇ ਹੈ ਤਾਂ ਇਸ ਲਈ ਸਾਨੂੰ ਆਪਣੇ ਸਰੀਰ ਦੀ ਜਿਹੜੀ ਸੰਭਾਲ ਆ ਉਹ ਖੁਦ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਅੰਦਰੂਨੀ ਅੰਗ ਫਿਰ ਹੀ ਸਹੀ ਤਰੀਕੇ ਨਾਲ ਕੰਮ ਕਰਨਗੇ ਜੇਕਰ ਅਸੀਂ ਆਪਣੇ ਸਰੀਰ ਦਾ ਧਿਆਨ ਰੱਖਾਂਗੇ ਰਨਿੰਗ ਕਰਾਂਗੇ ਐਕਸਾਈਜਾਂ ਕਰਾਂਗੇ ਯੋਗਾ ਕਰਾਂਗੇ ਜਿਮ ਜਾਵਾਂਗੇ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਸਹੀ ਸਮੇਂ ਦੇ ਉੱਤੇ ਨਿਰੰਤਰ ਕਰਨੀਆ ਚਾਹੀਦੀਆਂ ਹਨ